ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਇੱਥੇ ਨਵੀਂ ਸ਼ਿਫਟ ਹੋਈ ਹਾਂ ਅਤੇ ਮੈਂ ਤੁਹਾਨੂੰ ਨਾ ਇੱਥੋਂ ਦੇ ਮਿਊਜਿਕ ਬਾਰੇ ਕੁਛ ਤੁਸੀਂ ਮਿਊਜਿਕ ਟੀਚਰ ਬੋਲਦੇ ਪਏ ਹੋ ਪ੍ਰਿਅੰਕਾ ਮੈਂ ਨਾ ਤੁਹਾਨੂੰ ਇੱਥੋਂ ਦੇ ਮਿਊਜਿਕ ਬਾਰੇ ਕੁਛ ਜਾਣਨਾ ਚਾਹੁੰਦੀ ਸੀ ਇੱਥੋਂ ਦਾ ਮਿਊਜਿਕ ਕਿਸ ਤਰ੍ਹਾਂ ਮਤਲਬ ਅਸੀਂ ਦੇਖ ਸਕਦੇ ਹਾਂ ਕੁਛ ਉਹਦੇ ਬਾਰੇ ਦੱਸ ਸਕਦੇ ਹੋ ਠੀਕ ਹੈ ਠੀਕ ਹੈ ਜੀ ਓਕੇ ਜੀ ਧੰਨਵਾਦ